ਹਾਂ ਮੈਨੂੰ ਇੱਕ ਵਾਰੀ ਬੜੀ ਆਫ਼ਤ ਹੀ ਆ ਗਈ ਸੀ ਖਾਣਾ ਬਣਾਉਣ ਦੀ ਮੈਨੂੰ ਨਹੀਂ ਆਈ ਸੀ ਅਸਲ 'ਚ ਮੇਰੇ ਗੁਆਂਡ ਦੇ ਵਿੱਚ ਇੱਕ ਰਹਿੰਦੇ ਨੇ ਉਹ ਕਹਿੰਦੇ ਸੀ ਛੇਤੀ ਛੇਤੀ ਆ ਅਤੇ ਖਾਣਾ ਬਣਾ ਕੇ ਦੇ ਉਹਨਾਂ ਦੇ ਘਰ ਗੈਸਟ ਆਏ ਸਨ ਅਤੇ ਉਹਨਾਂ ਲਈ ਖਾਣਾ ਬਣਾਉਣਾ ਸੀ ਅਤੇ ਉਹ ਫਿਰ ਮੈਨੂੰ ਕਹਿੰਦੇ ਕਿ ਛੋਲੇ ਪੂਰੀਆਂ ਬਣਾਉਣੀਆਂ ਨੇ ਜੀ ਅਤੇ ਫਿਰ ਮੈਨੂੰ ਬਣਾਉਣੀਆ ਪਈਆਂ ਜਾ ਕੇ ਕਿੰਨਾ ਸਾਰਾ ਟਾਈਮ ਲੱਗ ਗਿਆ ਮੈਨੂੰ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਉਹਨਾਂ ਦੇ ਘਰ ਜਾਣ ਲਈ ਫਿਰ ਮੈਂ ਉੱਥੇ ਜਾ ਕੇ ਖਾਣਾ ਬਣਾਇਆ ਮੁਸ਼ਕਿਲ ਵੀ ਲੱਗਿਆ ਸੀ ਥੋੜ੍ਹਾ ਜਿਹਾ ਕਿਉਂਕਿ ਇਕੋ ਦਮ ਹੀ ਉਨਾ ਨੇ ਕਹਿ ਦਿੱਤਾ ਨਾ ਫਿਰ ਆਫ਼ਤ ਹੀ ਆ ਗਈ ਬਸ ਵੀ ਬਣਾਓ ਫਟਾਫਟ ਬਣਾਉਣਾ ਹੀ ਪੈਣਾ ਕਿਉਂ ਕਿਉਂਕਿ ਗੈਸਟ ਆ ਗਏ ਸਨ ਉਹਨਾਂ ਪ੍ਰੋਣਿਆਂ ਨੇ ਵੀ ਪਹਿਲਾਂ ਦੱਸਿਆ ਨਹੀਂ ਸੀ ਕਿ ਅਸੀਂ ਆਉਣਾ ਅਚਾਨਕ ਆ ਗਏ ਅਤੇ ਫਿਰ ਬਣਾਉਣਾ ਪੈ ਗਿਆ ਚਲੋ ਉਂਝ ਤਾਂ ਬਣਾ ਲਿਆ ਸੀ ਫਿਰ ਬਣਾਇਆ ਫਿਰ ਜਾ ਕੇ ਫਿਰ ਥੋੜ੍ਹੀ ਹੌਲੀ ਹੌਲੀ ਆਪਣੇ ਦਿਮਾਗ ਨੂੰ ਸੈਟ ਕੀਤਾ ਕਿ ਚਲੋ ਗੈਸਟ ਆਏ ਨੇ ਜ਼ਰੂਰਤ ਪੈ ਗਈ ਬਣਾਉਣ ਦੀ ਅਤੇ ਬਣਾਉਣਾ ਪੈ ਗਿਆ ਕੋਈ ਗੱਲ ਨਹੀਂ ਹਾਂ ਮੇਰੇ ਇੱਕ ਦੋ ਆਪਣੇ ਕੰਮ ਛੁੱਟ ਗਏ ਰਹਿ ਗਏ ਸੀ ਕੁਨ ਕਰਨ ਵਾਲੇ ਉਹਨਾਂ ਕਰਕੇ ਥੋੜ੍ਹਾ ਮੈਨੂੰ ਔਖਾ ਲੱਗਾ ਸੀ ਪਰ ਨਹੀਂ ਫਿਰ ਉਹ ਵੀ ਕਰ ਲਏ ਬਾਅਦ ਦੇ ਵਿੱਚ ਮੈਂ ਚਲੋ ਕਿਸੇ ਤਰੀਕੇ ਸਹੀ ਰਿਹਾ ਮਤਲਬ ਅਤੇ ਆਪਣੇ ਦਿਮਾਗ ਨੂੰ ਵੀ ਸਹੀ ਕਰ ਲਿਆ ਮੈਂ ਬਾਅਦ ਵਿੱਚ ਠੀਕ ਰਿਹਾ ਮਤਲਬ ਵਧੀਆ ਬਣ ਗਿਆ ਸੀ ਫਿਰ